ਮੋਹਾਲੀ ਜ਼ਿਲ੍ਹਾ ਬਹੁਤ ਹੀ ਵਿਕਸਿਤ ਖੇਤਰ ਹੈ ਇੱਥੇ ਸਿਹਤ ਸੰਭਾਲ ਦੇ ਬਹੁਤ ਸਾਰੇ ਕੇਂਦਰ ਹਨ ਜਿਵੇਂ ਕਿ ਯੋਗਾ ਕਲਾਸਿਸ ਜਿੰਮ ਆਦਿ ਬਹੁਤ ਸਾਰੇ ਹਸਪਤਾਲ ਵੀ ਹਨ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲ ਦੋਨੋਂ ਹਨ ਜਿਵੇਂ ਕਿ ਫੋਰਟੀਜ਼ ਮੈਕਸ ਅਪੋਲੋ ਹਸਪਤਾਲ ਬਹੁਤ ਹੀ ਮਸ਼ਹੂਰ ਹਨ ਸਰਕਾਰੀ ਸਰਕਾਰੀ ਹਸਪਤਾਲ ਦੀ ਗੱਲ ਕਰੀਏ ਤਾਂ ਛੇ ਫੇਸ ਦਾ ਹਸਪਤਾਲ ਬਹੁਤ ਹੀ ਵਧੀਆ ਹੈ ਉੱਥੇ ਬਹੁਤ ਹੀ ਸਾਰੀਆਂ ਸਹੂਲਤਾਂ ਮਿਲਦੀਆਂ ਹਨ ਡਾਕਟਰ ਵੀ ਬਹੁਤ ਜ਼ਿਆਦਾ ਵਧੀਆ ਹਨ ਅਤੇ ਸਰਕਾਰੀ ਸਕੀਮਾਂ ਵੀ ਸਮੇਂ ਸਮੇਂ ਤੇ ਜ਼ਰੂਰਤਮੰਦਾਂ ਨੂੰ ਮਿਲਦੀਆਂ ਰਹਿੰਦੀਆਂ ਹਨ ਬਹੁਤ ਹੀ ਘੱਟ ਖਰਚੇ 'ਤੇ ਇਲਾਜ ਚੱਲਦਾ ਹੈ ਅਤੇ ਬਹੁਤ ਹੀ ਵਧੀਆ ਟਰੀਟਮੈਂਟ ਹੈ ਜੋ ਉਹ ਮਿਲਦਾ ਹੈ ਸਰਕਾਰ ਨੂੰ ਮੈਂ ਇਹ ਅਪੀਲ ਕਰਦੀ ਹਾਂ ਕਿ ਜੋ ਥੋੜ੍ਹੀ ਬਹੁਤੀ ਕਮੀ ਹੈ ਉਸ ਨੂੰ ਵੀ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਜੋ ਜ਼ਰੂਰਤਮੰਦ ਵਿਅਕਤੀਆਂ ਦੀ ਮਦਦ ਹੋ ਸਕੇ